ਹੈਲੋ ਮੀਸੋ ਮੈਂ ਤੁਹਾਡੀ ਐਪ 'ਤੇ ਹੀ ਹਰ ਵਾਰ ਕੁਝ ਨਾ ਕੁਝ ਮੰਗਵਾਉਂਦੀ ਰਹਿੰਦੀ ਹਾਂ ਇਸ ਵਾਰ ਵੀ ਮੈਂ ਤੁਹਾਡੇ ਤੋਂ ਕੰਨਾਂ ਦੇ ਟੋਪਸ ਮੰਗਵਾਏ ਸੀ ਪਰ ਮੰਗਵਾਏ ਸੀ ਮੈਨੂੰ ਉਹ ਟੋਪਸ ਬਹੁਤ ਪਸੰਦ ਸੀ ਮੈਂ ਇੰਨੇ ਦਿਨਾਂ ਤੋਂ ਉਹਨਾਂ ਦੀ ਉਡੀਕ ਕਰ ਰਹੀ ਸੀ ਕਰ ਰਹੀ ਸੀ ਕੱਲ੍ਹ ਮੈਨੂੰ ਆਡਰ ਦੀ ਡਿਲੀਵਰੀ ਹੋਈ ਸੀ ਮੈਨੂੰ ਤੁਹਾਡੀ ਮੀਸੋ ਦਾ ਮੈਸੇਜ ਮਿਲ ਗਿਆ ਵੀ ਤੁਸੀਂ ਮੈਨੂੰ ਡਿਲੀਵਰੀ ਕਰ ਦਿੱਤੀ ਪਰ ਮੈਨੂੰ ਆਡਰ ਮਿਲਿਆ ਹੀ ਨਹੀਂ ਇਸ ਇਸ ਲਈ ਇਸ ਦਾ ਕੋਈ ਹੱਲ ਕੀਤਾ ਜਾਵੇ ਫਿਰ ਮੇਰਾ ਫਿਰ ਮੇਰਾ ਆਡਰ ਭੇਜਿਆ ਜਾਵੇ ਧੰਨਵਾਦ